ਸਾਡੇ ਖੇਤਰ ਵਿੱਚ ਬਹੁਤ ਸਾਰੇ ਹੈਲਥ ਸੈਂਟਰ ਹਨ ਜਿਵੇਂ ਸੈਂਟਰ ਜਿੱਥੇ ਕੀ ਹਰ ਕੋਈ ਜਾ ਕੇ ਆਪਣੀ ਸਰੀਰ ਦੀ ਕਸਰਤ ਕਰਦਾ ਹੈ ਉਸ ਨਾਲ਼ ਫਿੱਟ ਰਹਿੰਦਾ ਹੈ ਸਵੇਰੇ ਸ਼ਾਮ ਜਿੰਮ 'ਚ ਹੁੰਦੇ ਨੇ ਮਿਹਨਤ ਕਰਦੇ ਨੇ ਖਾਣਾ ਵਧੀਆ ਖਾਂਦੇ ਨੇ ਹੈਲਥੀ ਖਾਣਾ ਹੁੰਦਾ ਹੈ ਉਹਨਾਂ ਦਾ ਜਿਸ ਕਰਕੇ ਉਹ ਫਿੱਟ ਰਹਿੰਦੇ ਨੇ ਅਤੇ ਹੋਸਪੀਟਲ ਤੋਂ ਬਚੇ ਰਹਿੰਦੇ ਨੇ ਜਾਣ ਤੋਂ ਬਾਕੀ ਅੱਜ ਕੱਲ੍ਹ ਹੋਸਪੀਟਲ 'ਚ ਵੀ ਬਹੁਤ ਸਾਰਾ ਬਦਲਾਵ ਆਇਆ ਹੈ ਸਾਫ ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੈ ਜਿਸ ਕਰਕੇ ਬਿਮਾਰੀਆਂ ਨਹੀਂ ਲੱਗਦੀਆਂ